ਮੇਰੇ ਖਿਆਲ ਦੇ ਨਾਲ ਸਾਡੇ ਮੁਹੱਲੇ ਵਿੱਚ ਡਿਸਪੈਂਸਰੀਆਂ ਤੇ ਬਹੁਤ ਜ਼ਿਆਦਾ ਜ਼ਰੂਰਤ ਹੈ ਅਤੇ ਗਲੀ ਮੁਹੱਲੇ ਦੇ ਬਾਹਰ ਇੱਕ ਅੱਧੀ ਡਿਸਪੈਂਸਰੀ ਹੋਣੀ ਬਹੁਤ ਹੀ ਲਾਜ਼ਮੀ ਹੈ ਡਿਸਪੈਂਸਰੀ ਦੇ ਅੰਦਰ ਹਰ ਟਾਈਮ ਇੱਕ ਅੱਧਾ ਡੋਕਟਰ ਅਤੇ ਉਹਦੇ ਨਾਲ ਸਟਾਫ ਦਾ ਹੋਣਾ ਵੀ ਜ਼ਰੂਰੀ ਹੈ ਜੋ ਕਿ ਵੈੱਲ ਐਜੂਕੇਟਿਡ ਹੋਣ ਡੋਕਟਰਾਂ ਨੂੰ ਕੋਨਫਰੈਂਸਿਸ 'ਤੇ ਬਹੁਤ ਜ਼ਿਆਦਾ ਜਾਣ ਦੀ ਜ਼ਰੂਰਤ ਹੈ ਤਾਂ ਕਿ ਉਹ ਅਪ ਆਪਣੀ ਬਿਮਾਰੀਆਂ ਨੂੰ ਲੈ ਕੇ ਅਤੇ ਲੋਕਾਂ ਦੀ ਬਿਮਾਰੀਆਂ ਨੂੰ ਲੈ ਕੇ ਅਪਡੇਟ ਹੁੰਦੇ ਰਹਿਣ ਤਾਂ ਕਿ ਉਹ ਲੋਕਾਂ ਦਾ ਸਹੀ ਢੰਗ ਦੇ ਨਾਲ ਇਲਾਜ ਕਰ ਸਕਣ ਡੋਕਟਰੀ ਸਹਾਇਤਾ ਮਿਲਣ 'ਤੇ ਹੀ ਬੰਦਾ ਜਦੋਂ ਟਾਈਮ ਟੂ ਟਾਈਮ ਬਚ ਵੀ ਸਕਦਾ ਹੈ ਅਤੇ ਮਰ ਵੀ ਸਕਦਾ ਹੈ ਸਾਡੇ ਮੁਹੱਲੇ ਵਿੱਚ ਹੋਰ ਵੀ ਬਹੁਤ ਜ਼ਿਆਦੀਆਂ ਬਿਮਾਰੀਆਂ ਫੈਲ ਰਹੀਆਂ ਹਨ ਅਤੇ ਪਿਛਲੇ ਸਾਲ ਗਈ ਕੋਵਿਡ ਨੇ ਬਹੁਤ ਹੀ ਮਹਾਂਮਾਰੀ ਫੈਲਾਈ ਸੀ ਜਿਹਦੇ ਕਾਰਨ ਡੋਕਟਰਾਂ ਦੀ ਕਮੀ ਹੋਣ ਕਾਰਨ ਸਾਡੇ ਮੁਹੱਲੇ ਵਿੱਚ ਬਹੁਤ ਹੀ ਜ਼ਿਆਦਾ ਮੌਤਾਂ ਨੂੰ ਮੌਤਾਂ ਦਾ ਸਾਹਮਣਾ ਹੋਣ ਕਰਨਾ ਪਿਆ ਸੀਗਾ ਸਾਡੇ ਮੁਹੱਲੇ ਵਿੱਚ ਡੋਕਟਰਾਂ ਅਤੇ ਸਿਹਤ ਸਿਹਤ ਅਧਿਕਾਰੀਆਂ ਨੂੰ ਲੈ ਕੇ ਬਹੁਤ ਹੀ ਸਤਰਕ ਹੋਣ ਦੀ ਲੋੜ ਹੈ ਜੋ ਕਿ ਅੱਜ ਤੱਕ ਅਸੀਂ ਨਹੀਂ ਦੇਖ ਸਕੇ ਸਾਡੇ ਮੁਹੱਲੇ ਵਿੱਚ ਗਲੀ ਮੁਹੱਲਿਆਂ ਵਿੱਚ ਡਿਸਪੈਂਸਰੀ ਤਾਂ ਖੁੱਲ੍ਹ ਰਹੀ ਹੈ ਪਰ ਉੱਥੇ ਨਾ ਹੀ ਡੋਕਟਰ ਮਿਲਦੇ ਹਨ ਅਤੇ ਨਾ ਹੀ ਪ੍ਰੋ ਸਹੀ ਤਰੀਕੇ ਨਾਲ ਇਲਾਜ ਹੋ ਪਾਉਂਦਾ ਹੈ ਜਿਹਦੇ ਕਾਰਨ ਕਾਫੀ ਜ਼ਿਆਦਾ ਲੋਕਾਂ ਨੂੰ